ਇਹਨਾਂ ਬਿਮਾਰੀਆਂ ਦੇ ਇਲਾਜ ਵਾਸਤੇ ਹੁਣ ਲੋਕ ਜ਼ਿਆਦਾਤਰ ਹਸਪਤਾਲਾਂ ਵਿੱਚ ਜਾਂਦੇ ਹਨ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਕਈ ਉਪਚਾਰ ਵੀ ਹੁੰਦੇ ਹਨ ਉਹਨਾਂ ਨੂੰ ਇਹਨਾਂ ਉਪਚਾਰਾਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਜਿਸ ਨਾਲ ਉਹ ਇਲਾਜ ਕਰ ਸਕਣ ਇਸ ਕਰਕੇ ਉਹ ਕਿਸੇ ਵੀ ਦਵਾਈ ਵਾਸਤੇ ਕਿਸੇ ਵੀ ਇਲਾਜ ਵਾਸਤੇ ਜ਼ਿਆਦਾਤਰ ਹਸਪਤਾਲਾਂ ਵਿੱਚ ਹੀ ਜਾਂਦੇ ਹਨ ਅਤੇ ਉਸੇ ਉੱਥੇ ਹੀ ਇਲਾਜ ਕਰਾਉਣੇ ਹਨ ਪਰ ਕੁਝ ਲੋਕ ਇਹੋ ਜਿਹੇ ਹਨ ਜਿਹਨਾਂ ਨੂੰ ਜੇ ਜੋ ਇਹਨਾਂ ਉਪਚਾਰਾਂ ਨੂੰ ਜਾਣਦੇ ਹਨ ਅਤੇ ਇਹਨਾਂ ਉਪਚਾਰਾਂ ਨਾਲ ਹੀ ਆਪਣਾ ਇਲਾਜ ਕਰਦੇ ਹਨ ਕਈ ਕਈ ਬਿਮਾਰੀਆਂ ਦਾ ਇਲਾਜ ਹੈ ਉਪਚਾਰਾਂ ਨਾਲ ਵੀ ਹੁੰਦਾ ਹੈ ਅਤੇ ਕਈ ਦਾ ਦਵਾਈਆਂ ਨਾਲ ਵੀ ਹੁੰਦਾ ਹੈ ਪਰ ਪੁਰਾਣੇ ਸਮਿਆਂ ਦੇ ਲੋਕ ਉਪਚਾਰਾਂ ਜੜੀ ਬੂਟੀਆਂ ਉਪਚਾਰਾਂ ਨਾਲ ਹੀ ਇਲਾਜ ਕਰਦੇ ਸਨ ਪਰ ਹੁਣ ਦੇ ਜਿਹੜੇ ਲੋਕ ਹਨ ਉਹ ਆਪਣਾ ਇਲਾਜ ਹਸਪਤਾਲਾਂ ਵਿੱਚ ਜਾ ਕੇ ਕਰਦੇ ਹਨ ਹੁਣ ਉਹ ਜਿਹੜੇ ਬੂਟਿਆਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਅਤੇ ਇਲਾਜ ਵਾਸਤੇ ਕਈ ਦਵਾਈਆਂ ਵੀ ਲੈਂਦੇ ਹਨ ਜੋ ਕੁਝ ਨੁਕਸਾਨ ਵੀ ਕਰਦੇ ਹਨ ਅਤੇ ਕੁਝ ਉਹਨਾਂ ਲਈ ਬਹੁਤ ਲਾਭਦਾਇਕ ਵੀ ਹੁੰਦੀਆਂ ਹਨ ਅਤੇ ਇਸ ਕਰਕੇ ਸਾਨੂੰ ਦੋਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਸਾਨੂੰ ਜ਼ਿਆਦਾਤਰ ਉ ਉਪਚਾਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਲਾਜ ਵਾਸਤੇ